ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਰਨਾਲਾ ਕਲੱਬ ਚੌਂ ਬੋਲਦੇ ਹੋ ਜੀ ਹਾਂਜੀ ਵੀਰ ਜੀ ਸਾਨੂੰ ਪਤਾ ਲੱਗਿਆ ਸਾਡੇ ਗੁਆਂਢ ਤੋਂ ਤੁਹਾਡੇ ਬੱਚੇ ਆਉਂਦੇ ਆ ਇੱਥੇ ਖੇਡਣ ਆਉਂਦੇ ਆ ਜੀ ਸਾਡੇ ਵੀ ਬੱਚੇ ਇੱਕ ਤਾਂ ਮੇਰੇ ਕੋਲ ਬੇਟੀ ਆ ਜੀ ਇੱਕ ਬੇਟਾ ਜੀ ਬੇਟੀ ਹੈਗੀ ਦਸ ਸਾਲਾਂ ਦੀ ਜੀ ਅਤੇ ਬੇਟਾ ਹੈਗਾ ਬਾਰਾ ਸਾਲਾਂ ਦਾ ਜੀ ਉਹ ਸਕੂਲੋਂ ਆਉਂਦੇ ਆ ਜੀ ਸਕੂਲੋਂ ਆ ਕੇ ਫੋਨ ਚੁੱਕ ਲੈਦਾ ਕੋਈ ਐਕਟੀਵਿਟੀ ਨਹੀਂ ਕਰਦੇ ਜੀ ਉਹਨਾਂ ਨੂੰ ਕਰਨਾ ਜੀ ਬੱਚਿਆਂ ਨੂੰ ਖੇਡ ਉਹ ਕਰਵਾਉਣੀ ਹੈ ਜੀ ਉਹਨਾਂ ਵਾਸਤੇ ਉਹ ਫੋਨ ਦੇਖਦੇ ਰਹਿੰਦੇ ਜੀ ਸਾਰਾ ਦਿਨ ਖੇਡ ਉਹਨਾਂ ਨੂੰ ਕੁਸ਼ਤੀ ਜ਼ਿਆਦਾ ਪਸੰਦ ਹੈ ਜੀ ਬੇਟੇ ਨੂੰ ਕੁਸ਼ਤੀ ਪਸੰਦ ਹੈ ਜੀ ਅਤੇ ਬੇਟੀ ਨੂੰ ਕਰਾਟੇ ਪਸੰਦ ਆ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਕੋਈ ਨਾ ਤੁਸੀਂ ਸਾਨੂੰ ਆਪਣਾ ਐਡਰੈਸ ਦੱਸ ਦਿਓ ਜੀ ਤਾਂ ਆਪਣਾ ਐਡਰੈਸ ਦੱਸ ਦਿਓ ਜੀ ਸਾਨੂੰ ਤੁਸੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਵੀਰ ਜੀ ਅਸੀਂ ਫਿਰ ਕੱਲ੍ਹ ਨੂੰ ਆਵਾਂਗੇ ਜੀ ਸੁਬਹ ਨੌਂ ਕੁ ਵਜੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਥੈਂਕ ਯੂ ਵੀਰ ਜੀ ਠੀਕ